ਸਾਡੇ ਪਿੰਡ ਦੇ ਨਾਲ ਇੱਕ ਜ਼ਿਲ੍ਹਾ ਹੈ ਬਠਿੰਡਾ ਉਸਦੇ ਵਿੱਚ ਇੱਕ ਕਿਲ੍ਹਾ ਹੈ ਜਿਹੜਾ ਕਿ ਦੱਸਿਆ ਜਾਂਦਾ ਹੈ ਜਾਂ ਮੰਨਿਆ ਜਾਂਦਾ ਹੈ ਅਤੇ ਪੜ੍ਹਿਆ ਵੀ ਜਾਂਦਾ ਹੈ ਕਿ ਉੱਥੇ ਉਹ ਕਿਲ੍ਹਾ ਬਹੁਤ ਪ੍ਰਸਿੱਧ ਹੈ ਉਸ ਦੀ ਚੋਟੀ 'ਤੇ ਇੱਕ ਗੁਰਦੁਆਰਾ ਸਾਹਿਬ ਵੀ ਸਥਿਤ ਹੈ ਅਤੇ ਕਿਲ੍ਹਾ ਬਹੁਤ ਜ਼ਿਆਦਾ ਸੋਹਣਾ ਹੈ ਦੇਖਣ ਯੋਗ ਹੈ ਮੰਨਣ ਯੋਗ ਹੈ ਉਹ ਕਿਲ ਕਿਲ੍ਹਾ ਬਹੁਤ ਹੀ ਇਤਿਹਾਸਿਕ ਹੈ ਉਹ ਕਿਲ੍ਹਾ ਇਤਿਹਾਸਿਕ ਵੀ ਹੈ ਅਤੇ ਮੰਨਿਆ ਵੀ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਵਿੱਚ ਉਹ ਬਣਿਆ ਬਣਾਇਆ ਗਿਆ ਸੀ ਉਸ ਤੋਂ ਪਹਿਲਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਕਿਲ੍ਹੇ ਨੂੰ ਤਿਆਰ ਕਰਵਾਇਆ ਸੀਗਾ ਪ੍ਰੋਪਰ ਤਿਆਰ ਨਹੀਂ ਸੀਗਾ ਪਰ ਤਿਆਰ ਕਰਵਾਇਆ ਸੀ ਤਾਂ ਕਿ ਉਸਦੇ ਵਿੱਚ ਉਹਨਾਂ ਦੇ ਸਾਥੀ ਰੁਕ ਸਕਣ ਠਹਿਰ ਸਕਣ ਆਰਾਮ ਕਰ ਸਕਣ ਉਹ ਕਿਲ੍ਹਾ ਬਹੁਤ ਹੀ ਪ੍ਰਸਿੱਧ ਹੈ ਇਹ ਕਿਲ੍ਹਾ ਇਹ ਇਸ ਕਿਲ੍ਹੇ ਦੀ ਸੁਰੰਗ ਜਿਹੜੀ ਬਣੀ ਹੋਈ ਹੈ ਉਹ ਬਠਿੰਡੇ ਤੋਂ ਲੈ ਕੇ ਬਠਿੰਡੇ ਸ਼ਹਿਰ ਦੇ ਵਿੱਚੋਂ ਵਿੱਚੋਂ ਲੈ ਕੇ ਬਠਿੰਡੇ ਸ਼ਹਿਰ ਦੇ ਵਿੱਚੋਂ ਵਿੱਚੋਂ ਲੈ ਕੇ ਹਨੂੰਮਾਨਗੜ੍ਹ ਜ਼ਿਲ੍ਹਾ ਰਾਜਸਥਾਨ ਦੇ ਵਿੱਚ ਨਿਕਲਦੀ ਹੈ ਇਹ ਬਹੁਤ ਹੀ ਲੰਬੀ ਸੁਰੰਗ ਸੀ ਪਹਿਲਾਂ ਪਰ ਹੁਣ ਤਾਂ ਨਹੀਂ ਬੰਦ ਕੀਤੀ ਹੋਈ ਹੈ ਅਤੇ ਇਹ ਮੰਨਿਆ ਜਾਂਦਾ ਸੀ ਕਿ ਜਦੋਂ ਆਹਾ ਮੁਗਲ ਸ਼ਾਸਕ ਜਦੋਂ ਆ ਜਾਂਦੇ ਸੀਗੇ ਕਮ ਹਮਲਾ ਕਰਨ ਵਾਸਤੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਥੀ ਕੁਝ ਆਪਦੀਆਂ ਜਨ ਜਿਹੜੀਆਂ ਕਿ ਜਾਨਾਂ ਬਚਾਉਣ ਵਾਸਤੇ ਆਪਦੇ ਗ੍ਰੰਥ ਸਾਹਿਬ ਨੂੰ ਬਚਾਉਣ ਵਾਸਤੇ ਉਸ ਸੁਰੰਗ ਦੇ ਨੀਚੋਂ ਨੀਚੋਂ ਆਪਦਾ ਸਮਾਨ ਸਮੁਨ ਲੈ ਕੇ ਜਾਂਦੇ ਹੁੰਦੇ ਸੀਗੇ ਅਤੇ ਉੱਧਰੋਂ ਵਾਪਸ ਵੀ ਲੈ ਕੇ ਆਉਂਦੇ ਸੀ ਕੁਝ ਲੈਣ ਦੇਣ ਦਾ ਸਮਰਥਨ ਸੀਗਾ ਉਹ ਕਰਦੇ ਹੁੰਦੇ ਸੀ ਜਿਹੜਾ ਕਿ ਆਮ ਤੌਰ 'ਤੇ ਸੜਕਾਂ ਤੋਂ ਨਹੀਂ ਲੈ ਕੇ ਜਾਇਆ ਸ ਜਾਇਆ ਜਾ ਸਕਦਾ ਸੀਗਾ ਫਿਰ ਉਹ ਸੁਰੰਗਾਂ ਦੇ ਵਿੱਚੋਂ ਰਾਹੀਂ ਸੁਰੰਗਾਂ ਰਾਹੀਂ ਲੈ ਕੇ ਜਾਂਦੇ ਸੀਗੇ ਲੈ ਕੇ ਵੀ ਆਉਂਦੇ ਸੀਗੇ ਅਤੇ ਉੱਥੇ ਰਾਜਸਥਾਨ ਦੇ ਵਿੱਚ ਮਹਾਰਾਜਾ ਜੀ ਸੀਗੇ ਇੱਕ ਅਤੇ ਉਹਨਾਂ ਨਾਲ ਲੈਣ ਦੇਣ ਬਣਿਆ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਅਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹ ਕਿਲ੍ਹੇ ਨੂੰ ਪੇਂਟ ਕਰਵਾਇਆ ਹੋਰ ਉੱਚੇ ਉਹਨਾਂ ਦੀ ਇਮਾਰਤ ਕੀਤੀ ਅਤੇ ਉਸ ਤੋਂ ਬਾਅਦ ਇਹ ਕਿਲ੍ਹਾ ਬਹੁਤ ਜ਼ਿਆਦਾ ਪ੍ਰਸਿੱਧ ਹੈ ਮੈਨੂੰ ਸਿਰਫ ਆਪਦੇ ਇਸ ਕਿਲ੍ਹੇ ਬਾਰੇ ਹੀ ਪਤਾ ਹੈ ਅਤੇ ਮੈਂ ਇਸ ਕਿਲ੍ਹੇ ਵਿੱਚ ਬਹੁਤ ਵਾਰੀ ਗਈ ਵੀ ਹਾਂ ਅਤੇ ਬਹੁਤ ਇਹ ਸੁੰਦਰ ਹੈ ਦੇਖਣ ਯੋਗ ਹੈ ਮੰਨਣ ਯੋਗ ਹੈ ਇਸ ਦੇ ਉੱਤੇ ਇੱਕ ਚੋਟੀ 'ਤੇ ਦੋ ਗੁਰਦੁਆਰੇ ਵੀ ਬਣੇ ਹੋਏ ਹਨ ਇੱਕ ਤਾਂ ਜਿਹੜਾ ਸੱਜੇ ਹੱਥ ਹੈ ਇੱਕ ਇਹ ਖੱਬੇ ਹੱਥ ਹੈ ਉੱਥੇ ਬੜੇ ਹੀ ਦਾਨ ਪੁੰਨ ਲੋਕ ਕਰਕੇ ਜਾਂਦੇ ਹਨ ਉੱਥੇ ਬਹੁਤ ਸਾਰੇ ਕਬੂਤਰ ਬਹਿੰਦੇ ਹਨ ਬਹੁਤ ਜ਼ਿਆਦਾ ਸੋਹਣਾ ਹੈ ਲੋਕ ਉੱਥੇ ਬਹੁਤ ਹੀ ਚੋਗਾ ਪਾ ਕੇ ਜਾਂਦੇ ਹਨ ਪਾਣੀ ਪਾਉਂਦੇ ਹਨ ਪੇੜ ਪੌਦੇ ਲੱਗੇ ਹੋਏ ਹਨ ਹਰਿਆਲੀ ਵੀ ਬਹੁਤ ਹੈ ਤੇ ਉਹ ਜਮਾਂ ਸ਼ ਬਠਿੰਡੇ ਸ਼ਹਿਰ ਦੇ ਵਿੱਚੋਂ ਵਿੱਚ ਹੈ ਧੰਨਵਾਦ